ਹੈਲੋ ਸਤਿ ਸ਼੍ਰੀ ਅਕਾਲ ਕੀ ਮੇਰੀ ਗੱਲ ਮਨਜੀਤ ਟਰੈਵਲਰਜ਼ ਨਾਲ ਹੋ ਰਹੀ ਹੈ ਪਰਸੋਂ ਮੈਂ ਤੁਹਾਡੇ ਤੋਂ ਇੱਕ ਕੈਬ ਬੁੱਕ ਕਰਵਾਈ ਸੀ ਪਟਿਆਲੇ ਟੂ ਚੰਡੀਗੜ੍ਹ ਪਰ ਕਿਸੀ ਕਾਰਨ ਕੱਲ੍ਹ ਮੈਨੂੰ ਰੱਦ ਕਰਵਾਉਣੀ ਪੈ ਗਈ ਮੈਨੂੰ ਕੋਲੇਜ 'ਚ ਕੋਈ ਕੰਮ ਪੈ ਗਿਆ ਸੀ ਅਤੇ ਮੈਂ ਤੁਹਾਨੂੰ ਐਡਵਾਂਸ ਪੰਜ ਸੌ ਰੁਪਇਆ ਸੈਂਡ ਕੀਤਾ ਸੀ ਆਪਣੇ ਨੰਬਰ ਤੋਂ ਤੁਸੀਂ ਇਸ ਨੰਬਰ 'ਤੇ ਮੈਨੂੰ ਬੈਕ ਸੈਂਡ ਕਰ ਦੇਣਾ ਅਤੇ ਮੈਂ ਥੁ ਆਪਣੀ ਪੇਮੈਂਟ ਦੀ ਵੇਟ ਕਰਾਂਗੀ ਧੰਨਵਾਦ